ਹੈਲੋ ਸਰ ਕੀ ਤੁਸੀਂ ਉਬੇਰ ਟਰਾਂਸਪੋਰਟ ਏਜੰਸੀ ਤੋਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਸਰ ਮੈਂ ਜੈਦੀਪ ਗੱਲ ਕਰ ਰਹੀ ਹਾਂ ਮੈਂ ਐਕਚੁਲੀ ਤੁਹਾਨੂੰ ਇੱਕ ਫੀਡਬੈਕ ਦੇਣਾ ਚਾਹਵਾਂਗੀ ਕੱਲ੍ਹ ਮੈਂ ਇੱਕ ਬੁੱਕ ਕੀਤੀ ਸੀਗੀ ਕੈਬ ਤੁਹਾਡੀ ਮੈਂ ਚੰਡੀਗੜ੍ਹ ਤੋਂ ਆ ਰਹੀ ਸੀਗੀ ਅਤੇ ਚੰਡੀਗੜ੍ਹ ਤੋਂ ਜਲੰਧਰ ਤੱਕ ਦਾ ਮੇਰਾ ਸਫ਼ਰ ਸੀਗਾ ਔਰ ਤੁਹਾਨੂੰ ਪਤਾ ਜਿੱਦਾਂ ਕਿ ਅੱਜ ਕੱਲ੍ਹ ਕੋਵਿਡ ਦਾ ਚੱਲ ਰਿਹਾ ਹੈਗਾ ਅਤੇ ਉਹਦੇ 'ਚ ਅਸੀਂ ਸਾਰੇ ਹੀ ਬਹੁਤ ਪ੍ਰੋਟੈਕਸ਼ਨ ਲੈ ਕੇ ਚਲਦੇ ਹਾਂ ਕਿ ਹਾਂਜੀ ਤਾਂ ਕਿ ਸਾਨੂੰ ਕੋਈ ਵੀ ਅਨਵੋਂਟਡ ਡਸਟ ਤੋਂ ਜਾਂ ਬੈਕਟੀਰੀਆਸ ਤੋਂ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਅਤੇ ਬਟ ਮੈਂ ਜਦੋਂ ਦੇਖਿਆ ਤਾਂ ਡਰਾਈਵਰ ਨੇ ਮਾਸਕ ਨਹੀਂ ਸੀ ਪਾਇਆ ਹੋਇਆ ਔਰ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮਾਸਕ ਵੀਅਰ ਕਰ ਲਓ ਤਾਂ ਪਹਿਲਾਂ ਤਾਂ ਉਹਨਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਡਰਾਈਵਰ ਦਾ ਨਾਮ ਸੀਗਾ ਮਨਜੀਤ ਸਿੰਘ ਔਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਮੈਂ ਥੋੜ੍ਹਾ ਜਿਹਾ ਗੁੱਸੇ ਹੋਈ ਕਿ ਨਹੀਂ ਭਾਅ ਜੀ ਇੱਦਾਂ ਅਸੀਂ ਬਿਮਾਰ ਹੋ ਜਾਵਾਂਗੇ ਜਾਂ ਫਿਰ ਤੁਸੀਂ ਆਪਣੀ ਕੈਂਸਲ ਕਰ ਦਿਓ ਫਿਰ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਾਸਕ ਪਾਇਆ ਔਰ ਜਦੋਂ ਗੱਡੀ ਦੇ ਵਿੱਚ ਬੈਠੇ ਹਾਂ ਤਾਂ ਗੱਡੀ ਦੇ ਵਿੱਚ ਦੇਖਿਆ ਕਿ ਸੀਟਾਂ ਜਿਹੜੀਆਂ ਸੀਗੀਆਂ ਉਹ ਬਹੁਤ ਗੰਦੀਆਂ ਸੀਗੀਆਂ ਔਰ ਕੈਬ ਵੀ ਜਿਹੜੀ ਸੀਗੀ ਤਾਂ ਉਹ ਬਿਲਕੁਲ ਕਲੀਨ ਨਹੀਂ ਸੀਗੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਹਿਲਾਂ ਪਲੀਜ਼ ਆਪਣੀ ਕੈਬ ਥੋੜ੍ਹੀ ਜਿਹੀ ਸਾਫ਼ ਕਰੋ ਸੀਟਾਂ ਥੋੜ੍ਹੀਆਂ ਜਿਹੀਆਂ ਸਾਫ਼ ਕਰੋ ਸੋ ਦੈਟ ਕਿ ਅਸੀਂ ਬੈਠਣਾ ਤਾਂ ਸਾਨੂੰ ਇਨਫੈਕਸ਼ਨ ਨਾ ਹੋਵੇ ਔਰ ਉੱਥੇ ਪਹਿਲਾਂ ਸ਼ਾਇਦ ਜਿਹੜੇ ਵੀ ਕਸਟਮਰਸ ਨੇ ਟਰੈਵਲ ਕੀਤਾ ਸੀਗਾ ਤੋ ਉੱਥੇ ਉਹਨਾਂ ਦੀਆਂ ਗੰਦੇ ਮਾਸਕ ਪਏ ਹੋਏ ਸੀਗੇ ਕਾਗਜ਼ ਵਗੈਰਾ ਕਾਫ਼ੀ ਬਿਖਰੇ ਹੋਏ ਸੀਗੇ ਤੋ ਮੇਰੀ ਇੱਕ ਫੀਡਬੈਕ ਸੀਗੀ ਕਿ ਜਦੋਂ ਵੀ ਤੁਸੀਂ ਇੱਦਾਂ ਆਪਣੀ ਕੈਬ ਨੂੰ ਕਿਸੇ ਕੋਲ ਭੇਜਦੇ ਹੋ ਕਿਸੇ ਵੀ ਕਸਟਮਰ ਦੇ ਕੋਲ ਤਾਂ ਉਹ ਪਲੀਜ਼ ਥੋੜ੍ਹਾ ਜਿਹਾ ਕਲੀਨ ਐਂਡ ਨੀਟ ਐਂਡ ਕਲੀਨ ਹੋਣੀ ਚਾਹੀਦੀ ਆ ਸੋ ਦੈਟ ਕਿ ਜਦੋਂ ਕਸਟਮਰ ਬੈਠਣ ਤਾਂ ਔਰ ਤੁਹਾਡੀ ਕੈਬ ਫੈਸਿਲਟੀ ਯੂਜ ਕਰਨ ਤਾਂ ਉਹਨਾਂ ਨੂੰ ਕਾਫ਼ੀ ਅੱਛਾ ਫੀਲ ਹੋਵੇ ਦੈਟਸ ਇਟ ਫਰੋਮ ਮਾਈ ਸਾਈਡ ਮੈਂ ਇਹ ਹੀ ਕਹਿਣਾ ਚਾਹਵਾਂਗੀ ਕਿ ਨੈਕਸਟ ਟਾਈਮ ਤੋਂ ਕਿਉਂਕਿ ਅਗਰ ਤੁਸੀਂ ਕਹੋ ਕਿ ਦੁਬਾਰਾ ਮੈਂ ਤੁਹਾਡੀਆਂ ਸਰਵਿਸਿਸ ਲਵਾਂਗੀ ਤਾਂ ਕਦੇ ਵੀ ਨਹੀਂ ਲਵਾਂ ਲਵਾਂਗੀ ਕਿਉੰਕਿ ਡਰਾਈਵਰ ਜਿਹੜਾ ਸੀਗਾ ਉਹ ਬਹੁਤ ਹੀ ਬਦਤਮੀਜ ਸੀਗਾ ਉਹਨੇ ਕਿਸੇ ਵੀ ਕੋਈ ਗੱਲ ਦਾ ਰੂਲਸ ਐਂਡ ਰੈਗੂਲੇਸ਼ਨਸ ਦਾ ਪਾਲਣ ਨਹੀਂ ਕੀਤਾ ਹੈਗਾ ਬਹੁਤ ਰੈਸ ਡਰਾਈਵਿੰਗ ਸੀਗੀ ਤੋ ਪਲੀਜ਼ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਥੈਂਕ ਯੂ